ਹੈਲੋ ਤੁਸੀਂ ਗੂਗਲ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਮੈਂ ਬਿੰਦੀਆਂ ਬੋਲ ਰਹੀ ਹਾਂ ਕੱਲ੍ਹ ਮੈਂ ਇੱਕ ਕੈਬ ਬੁੱਕ ਕੀਤੀ ਸੀ ਉਹਦਾ ਨੰਬਰ ਸੀਗਾ ਪੀ ਬੀ ਜ਼ੀਰੋ ਟੂ ਫੋਰ ਏਟ ਫਾਈਵ ਸਿਕਸ ਮੈਂ ਤੁਹਾਨੂੰ ਕੰਪਲੇਂਟ ਕਰਨਾ ਚਾਹੁੰਦੀ ਹਾਂ ਕਿ ਮੈਂ ਜਿਹੜੀ ਕੱਲ੍ਹ ਕੈਬ ਬੁੱਕ ਕੀਤੀ ਸੀ ਉਸ ਦੇ ਡਰਾਈਵਰ ਨੇ ਗੱਡੀ ਵਿੱਚ ਬਿਲਕੁਲ ਵੀ ਸਾਫ਼ ਸਫਾਈ ਨਹੀਂ ਰੱਖੀ ਸੀ ਬਹੁਤ ਘੱਟਾ ਮਿੱਟੀ ਧੂਲ ਮਿੱਟੀ ਸੀਗਾ ਅਤੇ ਗੰਦਗੀ ਵੀ ਬਹੁਤ ਸੀ ਗੱਡੀ 'ਚ ਪਤਾ ਨਹੀਂ ਕੀ ਇੱਕ ਅਜੀਬ ਜਿਹੀ ਬਦਬੂ ਆ ਰਹੀ ਸੀ ਪਿਛਲੀ ਸੀਟ 'ਤੇ ਈਵਨ ਕਿ ਇੱਕ ਬੱਚੇ ਦਾ ਡਾਈਪਰ ਵੀ ਪਿਆ ਹੋਇਆ ਸੀਗਾ ਪੋਕਟ 'ਚ ਅਤੇ ਉਹਨੇ ਉਹ ਬਿਲਕੁਲ ਸਾਫ਼ ਸਫਾਈ ਨਹੀਂ ਰੱਖੀ ਹੋਈ ਸੀ ਗੱਡੀ ਦੀ ਨਾ ਹੀ ਉਸ ਡਰਾਈਵਰ ਨੇ ਮਾਸਕ ਪਹਿਨਿਆ ਹੋਇਆ ਸੀ ਜਦੋਂ ਕਿ ਗਵਰਨਮੈਂਟ ਦੀਆਂ ਸਟ੍ਰਿਕਟ ਗਾਈਡਲਾਈਨ ਨੇ ਕਿ ਮਾਕਸ ਪਹਿਨਣਾ ਜ਼ਰੂਰੀ ਆ ਮੈਂ ਉਹਨੂੰ ਬੋਲਿਆ ਵੀ ਕਿ ਤੂੰ ਮਾਸਕ ਪਹਿਨ ਲੈ ਕਿ ਇਸ ਵਿੱਚ ਹੀ ਸਭ ਦੀ ਭਲਾਈ ਆ ਬਟ ਉਹਨੇ ਮਾਸਕ ਨਹੀਂ ਪਹਿਨਿਆ ਅਤੇ ਇਸ ਕਰਕੇ ਮੈਂ ਤੁਹਾਨੂੰ ਕੰਪਲੇਂਟ ਕਰਨਾ ਚਾਹੁੰਦੀ ਹਾਂ ਕਿ ਇਸ ਡਰਾਈਵਰ ਅਤੇ ਇਸ ਗੱਡੀ ਦੇ ਅਗੇਸਟ ਸਟਰ੍ਰਿਕਟ ਐਕਸ਼ਨ ਲਓ ਸੋ ਦੈਟ ਕਿ ਇਸ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤਾਂ ਮਾਸਕ ਪਹਿਨ ਲਿਓ ਪਹਿਨਣ ਲਈ ਉਹਨੂੰ ਡਰਾਈਵਰ ਨੂੰ ਅ ਸਮਝਾਓ ਕਿ ਆਪਾਂ ਨਾ ਆਪਣਾ ਨੁਕਸਾਨ ਕਰੀਏ ਨਾ ਕਿਸੇ ਹੋਰ ਦਾ